ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਵਧੀਆ ਜੀ ਤੁਸੀਂ ਸੁਣਾਓ ਹਾਂਜੀ ਮੇਰਾ ਤਾਂ ਹਜੇ ਥੋੜ੍ਹਾ ਹੀ ਆ ਹਾਂਜੀ ਹਾਂ ਮੈਨੂੰ ਵੀ ਇਹੀ ਟੈਨਸ਼ਨ ਆ ਹੁਣ ਬੱਚਿਆਂ ਦੇ ਐ ਐਕਸਟਰਾ ਪੀਰੀਅਡ ਲਗਾ ਕੇ ਫਿਰ ਕੰਪਲੀਟ ਕਰਾਂਗੇ ਜੇ ਬੱਚਿਆਂ ਦਾ ਸਿਲੇਬਸ ਸਿਲੇਬਸ ਨਹੀਂ ਪੂਰਾ ਹੈਗਾ ਹੈ ਤਾਂ ਫਿਰ ਸਾਡੇ 'ਤੇ ਜ਼ਿਆਦਾ ਪ੍ਰੈਸ਼ਰ ਪੈਣਾ ਮੈਂ ਕਿਹਾ ਕਿ ਜੇ ਬੱਚਿਆਂ ਦਾ ਸਿਲੇਬਸ ਨਹੀਂ ਕੰਪਲੀਟ ਹੋਇਆ ਫਿਰ ਸਾਡੇ 'ਤੇ ਸਾਡੇ 'ਤੇ ਜ਼ਿਆਦਾ ਪ੍ਰੈਸ਼ਰ ਪੈਣਾ ਹੈ ਹਾਂਜੀ ਤੁਸੀਂ ਵੀ ਹੁਣ ਆਪਣਾ ਦੇਖੋ ਮੈਂ ਆਪਣਾ ਦੇਖਦੀ ਹਾਂ ਹਾਂਜੀ ਹਾਂ ਮੀਟਿੰਗ ਮੀਟਿੰਗ ਕਰਕੇ ਮੇਰਾ ਹਾਂਜੀ ਹਾਂਜੀ ਚਲੋ ਠੀਕੇ ਹੈ ਫਿਰ ਓਕੇ ਓਕੇ ਬਾਏ ਫਿਰ ਚਲੋ ਠੀਕ ਹੈ ਓਕੇ ਬਾਏ ਹਾਂਜੀ ਚਲੋ ਠੀਕੇ ਹੈ